ਹਰ ਮਨੁੱਖ ਦਾ ਆਪਣਾ ਦ੍ਰਿਸ਼ਟੀਕੋਣ ਜ਼ਰੂਰ ਹੈ ਅਤੇ ਹਰ ਬੰਦੇ ਦੀ ਸੂਝ ਦਾ ਦੂਜੇ ਦੀ ਸੂਝ ਨਾਲੋਂ ਭੇਦ ਹੈ ਇਹੋ ਕਾਰਨ ਹੈ ਕਿ ਅਸਲੀਅਤ ਤੱਕ ਪਹੁੰਚਣ ਲਈ ਕਲਾ ਦੀ ਥਾਂ ਵਿਗਿਆਨਕ ਤਰੀਕੇ ਦੀ ਲੋੜ ਪੈਂਦੀ ਹੈ ਵਿਗਿਆਨਕ ਪਦਾਰਥ ਵੀ ਹੈ ਸਮਾਜਿਕ ਵੀ ਹੈ ਅਤੇ ਵਿਗਿਆਨ ਦੀਆਂ ਅਨੇਕ ਸ਼ਾਖਾ ਹਨ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਸਮਾਜ ਆਦੀ ਸਾਮਵਾਦੀ ਪੜਾਵ ਨੂੰ ਲੰਘਦੇ ਸਾਰ ਸ੍ਰੇਣੀਆਂ ਵਿੱਚ ਵੰਡੀ ਗਈ ਅਤੇ ਇਹਨਾਂ ਸ਼੍ਰੇਣੀਆਂ ਦੇ ਆਪਸੀ ਘੋਲ ਰਾਹੀ ਸਮਾਜਿਕ ਤਪਦੀ ਤਬਦੀਲੀਆਂ ਹੋਂਦ ਵਿੱਚ ਆਈਆਂ ਤਿੰਨ ਮੋਟੀਆਂ ਅਤੇ ਸਪਸ਼ਟ ਸਟੇਜਾਂ ਵਿੱਚ ਵਿਕਾਸ ਦੇ ਲੰਬੇਪੰਦ ਵਿੱਚ ਵਾਪਰੀਆਂ ਗੁਲਾਮੀ ਦੀ ਸਟੇਜ ਸਮਤੀ ਦੀ ਸਟੇਜ 'ਤੇ ਪੂੰਜੀਸ਼ਾਹੀ ਦੀ ਸਟੇਜ ਆਰੰਭ ਵਿੱਚ ਮਾਲਕ ਅਤੇ ਗੁਲਾਮ ਦੀ ਪ੍ਰਥਾ ਚੱਲੀ ਗੁਲਾਮ ਸ਼੍ਰੇਣੀ ਨੂੰ ਮਾਲਕ ਨੂੰ ਹਿਲਾਉਣੀਆਂ ਅਤੇ ਨਵੀਂ ਜ਼ਿੰਮੇਦਾਰੀਆਂ ਸਟੇਜ ਹੋਂਦ ਵਿੱਚ ਆਈ ਇਹ ਸਟੇਜ ਯੁੱਗ ਅਖਵਾਉਂਦੀ ਹੈ ਫਿਰ ਪੰਜਪੱਤੀਆਂ ਦੇ ਕੋਲ ਪਿੱਛੇ ਜਦ ਸਮਾਜਵਾਦੀ ਸ ਸਥਾਪਨਾ ਹੁੰਦੀ ਹੈ ਤਾਂ ਇ ਇੰਨਕਲਾਬੀ ਤੌਰ 'ਤੇ ਬਦਲਦੀ ਹੈ ਮਾਸ ਮਾਰਕਸ਼ਵਾਦੀ ਦ੍ਰਿਸ਼ਟੀ ਅਨੁਸਾਰ ਅਸਲ ਤਾਂ ਨਹੀਂ ਅਸਲੀਅਤ ਉਹ ਹੈ ਜਿਸ ਦੀਆਂ ਦੋ ਬੁਣਾਈਆਂ ਸਚਾਈਆਂ ਦਾ ਉੱਪਰ ਉਲੇਖ ਆਇਆ ਇਹ ਨਿਰਣਾ ਦੀ ਸਮਾਜ ਦੀ ਅਸਲ ਸੱਚਾਈ ਹੈ ਪਦਾਰਥ ਨੂੰ ਸਮਝਣਾ ਸਤਿਕਾਰ ਦਾ ਫਰਜ਼ ਹੈ ਫਿਰ ਇਸ ਪਦਾਰਥ ਨੂੰ ਸੂਚੀ ਸਾਹਿਤ ਰਚਨਾ ਵਿੱਚ ਨਿਭਾਉਣਾ ਸਤਿਕਾਰ ਦਾ ਦੂਜਾ ਫਰਜ਼ ਹੈ